ਸਾਡੇ ਪੁਰਾਣੇ ਸੱਭਿਆਚਾਰ ਵਿੱਚ ਔਰਤਾਂ ਵਿੱਚ ਮਹਾਵਾਰੀ ਦਾ ਇਲਾਜ ਕੱਪੜੇ ਦੀ ਵਰਤੋਂ ਕਰਕੇ ਕੀਤਾ ਜਾਂਦਾ ਸੀ ਮਹਾਵਾਰੀ ਦੌਰਾਨ ਔਰਤਾਂ ਨੂੰ ਕਈ ਤਰ੍ਹਾਂ ਦੇ ਪਾਲਣ ਕਰਨੇ ਪੈਂਦੇ ਸੀ ਪੁਰਾਣੇ ਸੱਭਿਆਚਾਰ ਵਿੱਚ ਜਦੋਂ ਔਰਤਾਂ ਨੂੰ ਮਹਾਵਾਰੀ ਆਉਂਦੀ ਸੀ ਅਤੇ ਨਾ ਹੀ ਉਹਨਾਂ ਨੂੰ ਰਸੋਈ ਘਰ ਵਿੱਚ ਜਾਣਾ ਪੈਦਾ ਸੀ ਅਤੇ ਨਾ ਹੀ ਕਿਸੇ ਖੁੱਲ੍ਹੇ ਅ ਖੁੱਲ੍ਹੇ ਵਿੱਚ ਜਾਣਾ ਪੈਂਦਾ ਸੀ ਅੱਜ ਕੱਲ੍ਹ ਆਧੁਨਿਕ ਯੁੱਗ ਵਿੱਚ ਸੱਭਿਆਚਾਰ ਵਿੱਚ ਔਰਤਾਂ ਵਿੱਚ ਮਹਾਵਾਰੀ ਦਾ ਇਲਾਜ ਕਈ ਤਰ੍ਹਾਂ ਦੀਆਂ ਪੈਡ ਦੇ ਯੂਜ ਨਾਲ ਕੀਤਾ ਜਾਂਦਾ ਹੈ ਇਸ ਦੀ ਵਰਤੋਂ ਕਰਕੇ ਨਾ ਤਾਂ ਕੋਈ ਬਿਮਾਰੀ ਲੱਗ ਸਕਦੀ ਹੈ ਅਤੇ ਸਵੱਛਤਾ ਦਾ ਵੀ ਕਾਫ਼ੀ ਜਾਗਰੂਕ ਕੀਤਾ ਜਾਂਦਾ ਹੈ